ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਇਸ ਕਰਕੇ ਫੋਨ ਕਰ ਰਹੀ ਹਾਂ ਕਿ ਆਪਾਂ ਸਾਰਿਆਂ ਨੇ ਇੱਕ ਗਰੁੱਪ ਬਣਾ ਕੇ ਸ਼੍ਰੀ ਹਜ਼ੂਰ ਸਾਹਿਬ ਦੀ ਯਾਤਰਾ 'ਤੇ ਜਾਣਾ ਹੈ ਇਸ ਕਰਕੇ ਸਾਨੂੰ ਪਹਿਲਾਂ ਹੀ ਰੇਲ ਯਾਤਰਾ ਦੀਆਂ ਸੀਟਾਂ ਬੁੱਕ ਕਰਵਾਉਣੀਆਂ ਪੈਣਗੀਆਂ

ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਕਿੰਨੇ ਮੈਂਬਰ ਸਾਡੇ ਨਾਲ ਜਾਣਾ ਪਸੰਦ ਕਰੋਗੇ ਅਤੇ ਕੀ ਤੁਹਾਨੂੰ ਪਤਾ ਹੈ ਕਿ ਟਿਕਟ ਕਾਊਂਟਰ ਉੱਪਰ ਆਪਾਂ ਕਿਹੜੇ ਸਮੇਂ ਜਾਈਏ ਜਦੋਂ ਉੱਥੇ ਬਹੁਤ ਭੀੜ ਘੱਟ ਹੋਵੇ ਅਤੇ ਸਾਨੂੰ ਆਪਣੀਆਂ ਮਨ ਪਸੰਦ ਸੀਟਾਂ ਵੀ ਮਿਲ ਜਾਣ ਇਹਨਾਂ ਸੀਟਾਂ ਦੀ ਉਪਲੱਬਧਤਾ ਸਾਨੂੰ ਆਸਾਨੀ ਨਾਲ ਹੋਵੇ ਤਾਂ ਕਿ ਦੋ ਦਿਨ ਦੋ ਰਾਤਾਂ ਦਾ ਇਹ ਸਫ਼ਰ ਸਾਡਾ ਸੌਖਾ ਨਿਕਲ ਜਾਵੇ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਸਾਡੇ ਜਿਹੜੇ ਪਰਿਵਾਰਿਕ ਮੈਂਬਰ ਹਨ ਉਹਨਾਂ ਦੀਆਂ ਸੀਟਾਂ ਬਜ਼ੁਰਗਾਂ ਦੀਆਂ ਨੀਚੇ ਵਾਲੀਆਂ ਹੋਣ ਬੱਚਿਆਂ ਅਤੇ ਨੌਜਵਾਨਾਂ ਦੀਆਂ ਸੀਟਾਂ ਉੱਪਰ ਹੋਣ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਨਾਲ ਜ਼ਰੂਰ ਸਹਿਮਤ ਹੋਵੋਗੇ ਅਤੇ ਮੈਨੂੰ ਸਾਰਾ ਵੇਰਵਾ ਜਲਦੀ ਤੋਂ ਜਲਦੀ ਭੇਜ ਦਿਓ ਤਾਂ ਕਿ ਆਪਾਂ ਆਪਣੀ ਯਾਤਰਾ ਦੀ ਤਰੀਕ ਅਤੇ ਰੂਟ ਨਿਸ਼ਚਿਤ ਕਰ ਸਕੀਏ ਧੰਨਵਾਦ ਜੀ ਸਤਿ ਸ਼੍ਰੀ ਅਕਾਲ